ਪੰਜਾਬ ਵਿੱਚ ਬਹੁਤ ਸਾਰੇ ਪ੍ਰਮੁੱਖ ਪ੍ਰੋਗਰਾਮਾਂ ਦਾ ਉਦੇਸ਼ ਮੀਡੀਆ ਸਾਖਰਤਾ ਜਾਂ ਪੱਤਰਕਾਰੀ ਸਿੱਖਿਆਂ ਨੂੰ ਉਤਸ਼ਾਹਿਤ ਕਰਨਾ ਹੈ ਪੰਜਾਬ ਵਿੱਚ ਸਰਕਾਰ ਅਤੇ ਸਰਕਾਰ ਦੇ ਕੰਮ ਹੀ ਜ਼ਿਆਦਾਤਰ ਮੀਡੀਆ ਨੂੰ ਉਤਸ਼ਾਹਿਤ ਕਰਦੇ ਹਨ ਮੀਡੀਆ 'ਤੇ ਜ਼ਿਆਦਾਤਰ ਸਰਕਾਰ ਦੇ ਹੀ ਕੰਮਾਂ ਜਾਂ ਕਾਰਜਾਂ ਬਾਰੇ ਦਿਖਾਇਆ ਅਤੇ ਦੱਸਿਆ ਜਾਂਦਾ ਹੈ ਅਤੇ ਮੀਡੀਆ ਨੂੰ ਸਰਕਾਰ ਆਪਣੇ ਹੀ ਅੱਗੇ ਪਿੱਛੇ ਰੱਖਦੀ ਹੈ ਅਤੇ ਇਸ ਅਤੇ ਪੰਜਾਬ ਅਤੇ ਪੰਜਾਬ ਹੋਰ ਅਤੇ ਇਸ 'ਤੇ ਪੰਜਾਬ ਦੇ ਹੋਰ ਮਸਲੇ ਦਿਖਾਉਣ ਦੀ ਬਜਾਏ ਸਰਕਾਰ ਦੇ ਬੇ ਮਤਲਬੀ ਕੰਮ ਹੀ ਦਿਖਾਏ ਜਾਂਦੇ ਹਨ ਅਤੇ ਜ਼ਿਆਦਾਤਰ ਬਸ ਮੀਡੀਆ ਸਰਕਾਰ ਦੇ ਹੀ ਅੱਗੇ ਪਿੱਛੇ ਕੰਮ ਕਾਰਜ ਇਹੀ ਦਿਖਾਉਂਦੀ ਹੈ ਜਿਹੜੇ ਕਿ ਬੇ ਮਤਲਬੀ ਜਾਂ ਫਜ਼ੂਲ ਦੇ ਹੋਣ ਜਿਨਾਂ ਨੂੰ ਦਿਖਾਉਣ ਦੀ ਬਜਾਏ ਪੰਜਾਬ ਦੇ ਮਸਲਿਆਂ ਬਾਰੇ ਦਿਖਾਉਣਾ ਚਾਹੀਦਾ ਹੈ ਪੰਜਾਬ 'ਚ ਹੋਰ ਵੀ ਬੇਰੁਜ਼ਗਾਰੀ ਹੋਰ ਵੀ ਬਹੁਤ ਸਾਰੇ ਮਸਲੇ ਹਨ ਜਿਹੜੇ ਨਹੀਂ ਦਿਖਾਏ ਜਾ ਰਹੇ